ਕਾਫੀ ਸਾਰੇ ਤਰੀਕੇ ਦੀਆਂ ਬਾਹਰੀ ਗਤੀਵਿਧੀਆਂ ਨੇ ਜਿਹਨਾਂ ਦਾ ਅਸੀਂ ਅਲੱਗ ਅਲੱਗ ਤਰੀਕੇ ਨਾਲ ਅਨੰਦ ਮਾਣਦੇ ਹਾਂ ਹਰੇਕ ਦੇ ਮੂਡ 'ਤੇ ਡਿਪੈਂਡ ਕਰਦਾ ਕਿ ਓਹ ਕਿਵੇਂ ਦੀਆਂ ਬਾਹਰੀ ਗਤੀਵਿਧੀਆਂ ਖੇਡਣਾ ਪਸੰਦ ਕਰਦੇ ਨੇ ਕਈ ਲੋਕਾਂ ਨੂੰ ਤੈਰਾਕੀ ਪਸੰਦ ਹੁੰਦੀ ਹੈ ਕਈਆਂ ਨੂੰ ਕ੍ਰਿਕਟ ਖੇਡਣਾ ਦੇਖਣਾ ਅਤੇ ਕਈਆਂ ਨੂੰ ਟਰੈਕਿੰਗ ਆਦਿ ਵੀ ਪਸੰਦ ਹੁੰਦੀ ਹੈ ਟਰੈਕਿੰਗ ਕਰਨ ਲਈ ਉਹ ਕਾਫੀ ਵੱਖ ਵੱਖ ਸਥਾਨਾਂ 'ਤੇ ਜਾਂਦੇ ਨੇਗੇ ਪਰ ਮੈਨੂੰ ਇਹਨਾਂ ਤਿੰਨਾਂ ਵਿੱਚੋਂ ਪਸੰਦ ਹੈ ਕ੍ਰਿਕਟ ਖੇਡਣਾ ਅਤੇ ਦੇਖਣਾ ਖੇਡੀ ਤਾਂ ਮੈਂ ਬਹੁਤ ਹੀ ਘੱਟ ਹੈ ਪਰ ਇਹਨੂੰ ਮੈਂ ਦੇਖਿਆ ਜ਼ਿਆਦਾ ਇਸ ਵਾਰੀ ਸਾਡੇ ਹੋਇਆ ਸੀਗਾ ਵਲਡ ਕੱਪ ਹੋਇਆ ਸੀ ਇੰਡੀਆ ਅਤੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਕਿ ਇਹ ਵਲਡ ਕੱਪ ਸੀਗਾ ਇਹਦੇ ਵਿੱਚ ਕਾਫੀ ਸਾਰੇ ਭਾਰਤੀਆਂ ਦੇ ਕ੍ਰਿਕਟ ਮੈਂਬਰਾਂ ਨੇ ਵੀ ਹਿੱਸਾ ਲਿਆ ਸੀਗਾ ਪਰ ਉਹਨਾਂ ਦੀ ਉਹਨਾਂ ਨੇ ਕਾਫੀ ਵਧੀਆ ਪ੍ਰਦਰਸ਼ਨ ਵੀ ਕੀਤਾ ਸੀ ਇਹਦੇ ਵਿੱਚ ਪਰ ਬਾਦ 'ਚ ਉਹਨਾਂ ਦੀ ਹਾਰ ਹੋਈ ਸੀ ਇਸ ਵਿੱਚ ਹਾਰ ਜਿੱਤ ਤਾਂ ਚਲੋ ਚੱਲਦੀ ਹੀ ਰਹਿੰਦੀ ਹੈ ਪਰ ਜਿਹੜੀ ਕ੍ਰਿਕਟ ਦੇ ਵਿੱਚ ਉਹਨਾਂ ਨੇ ਕਾਫੀ ਸਾਰਾ ਵਧੀਆ ਪ੍ਰਦਰਸ਼ਨ ਕੀਤਾ ਸੀਗਾ ਪਰ ਉਹ ਹਾਰ ਗਏ ਸੀ ਤਾਂ ਕਰਕੇ ਜ ਜਿੱਤੀ ਹੋਈ ਟੀਮ ਸੀਗੀ ਆਸਟ੍ਰੇਲੀਆ ਦੀ ਪਰ ਹੁਣ ਮੈਨੂੰ ਇੰਤਜ਼ਾਰ ਰਹੇਗਾ ਕਿ ਕਦ ਦੁਬਾਰਾ ਆਈ ਪੀ ਐੱਲ ਆਵੇ ਅਤੇ ਉਹਨੂੰ ਮੈਂ ਦੇਖਾਂ ਅਤੇ ਇੰਡੀਆ ਨੂੰ ਜਿੱਤਦੇ ਹੋਏ ਦੇਖਾਂ